ਭਾਰਤ ਦੇਸ਼ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਹਨ ਜਿਨ੍ਹਾਂ ਦੇ ਵਿੱਚੋਂ ਹਿੰਦੀ ਪੰਜਾਬੀ ਅੰਗਰੇਜੀ ਉਰਦੂ ਮਾਰਵਾੜੀ ਬੰਗਾਲੀ ਗੁਜਰਾਤੀ ਤਾਮਿਲ ਅਸਾਮੀ ਅਤੇ ਇਸ ਤੋਂ ਬਿਨਾਂ ਕਈ ਹੋਰ ਵੀ ਭਾਸ਼ਾਵਾਂ ਹਨ ਜਿਹੜੀਆਂ ਕਿ ਲੋਕ ਆਪਸ ਦੇ ਵਿੱਚ ਬੋਲਚਾਲ ਦੇ ਵਿੱਚ ਵਰਤਦੇ ਹਨ ਕਿਉਂਕਿ ਹਰ ਸਟੇਟ ਦੀ ਹਰ ਰਾਜ ਦੀ ਆਪਣੀ ਭਾਸ਼ਾ ਹੈ ਅਤੇ ਹਰ ਵਿਅਕਤੀ ਜਿਹੜਾ ਪਹਿਲਾਂ ਆਪਣੀ ਮਾਂ ਬੋਲੀ ਦੀ ਹੀ ਵਰਤੋਂ ਕਰਦਾ ਹੈ ਅਤੇ ਇਸ ਤਰ੍ਹਾਂ ਹੀ ਜਦੋਂ ਦੇਸ਼ ਦੀਆਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਹੁੰਦੀਆਂ ਹਨ ਤਾਂ ਉਸ ਤਰ੍ਹਾਂ ਹੀ ਇਹ ਭਾਸ਼ਾਈ ਵਿਭਿੰਨਤਾ ਵੀ ਹੁੰਦੀ ਹੈ ਭਾਸ਼ਾਈ ਵਿਭਿੰਨਤਾ ਦੇ ਕਿ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਦੂਜੀਆਂ ਭਾਸ਼ਾਵਾਂ ਨੂੰ ਪੜ੍ਹਦੇ ਨੇ ਜਾਣਦੇ ਨੇ ਉਨਾਂ ਦੇ ਬਾਰੇ ਇੱਕ ਦੂਜੇ ਦੇ ਨਾਲ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਤਾਂ ਇਹਦੇ ਨਾਲ ਉਹ ਦੂਜੀ ਭਾਸ਼ਾ ਨੂੰ ਜਾਣ ਜਦੋਂ ਜਾਣ ਜਾਂਦੇ ਨੇ ਅਤੇ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਔਰ ਇਹਦੇ ਨਾਲ ਨਾਲ ਗਿਆਨ ਦੇ ਵਾਧੇ ਦੇ ਨਾਲ ਨਾਲ ਉਹਨਾਂ ਦੀ ਸੱਭਿਆਚਾਰਕ ਵੀ ਜ਼ਿਆਦਾ ਪ੍ਰਫੁੱਲਤਾ ਹੁੰਦੀ ਹੈ ਕਿ ਉਹ ਦੂਜਿਆਂ ਦੇ ਸੱਭਿਆਚਾਰ ਨੂੰ ਜਾਣਦੇ ਹਨ ਦੂਜਿਆਂ ਦੇ ਰਹਿਣ ਸਹਿਣ ਬਾਰੇ ਜਾਣਦੇ ਹਨ ਖਾਣ ਪੀਣ ਬਾਰੇ ਜਾਣਦੇ ਹਨ ਕਿ ਇਸ ਤਰ੍ਹਾਂ ਜਿਹੜੀ ਭਾਸ਼ਾਈ ਵਿਭਿੰਨਤਾ ਹੈ ਉਹ ਵੀ ਲੋਕਾਂ ਦੇ ਵਿੱਚ ਜਿਹੜੀ ਹੈ ਜੇ ਹੁੰਦੀ ਹੈ ਤਾਂ ਉਹਦੇ ਨਾਲ ਇੱਕ ਦੂਜੇ ਦੇ ਨਾਲ ਉਹਨਾਂ ਦੇ ਵਿੱਚ ਸੱਭਿਆਚਾਰਕ ਵਾਧਾ ਵੀ ਹੁੰਦਾ ਹੈ